ਉੱਤਰੀ ਪੰਜਾਬ ਵਿੱਚ ਪਾਕਿਸਤਾਨ ਦੀ ਸੀਮਾ ਲੱਗਦੀ ਹੈ ਅਤੇ ਇਸ ਵਿੱਚ ਮਾਝਾ ਖੇਤਰ ਆਉਂਦਾ ਹੈ ਅਤੇ ਦੱਖਣ ਨੂੰ ਹਰਿਆਣੇ ਦੀ ਸੀਮਾ ਲੱਗਦੀ ਹੈ ਇਸ ਅਧੀਨ ਮਾਲਵਾ ਖੇਤਰ ਆਉਂਦਾ ਹੈ ਮਾਲਵਾ ਖੇਤਰ ਖੇਤਰਫ਼ਲ ਵਜੋਂ ਮਾਝੇ ਨਾਲੋਂ ਵੱਡਾ ਹੈ ਕੁਝ ਖੇਤਰਾਂ ਵਿੱਚ ਪਹਾੜੀ ਵੀ ਆਉਂਦੀਆਂ ਹਨ ਅਤੇ ਕੁਝ ਖੇਤਰ ਮੈਦਾਨੀ ਵੀ ਹੁੰਦੇ ਹਨ ਅਤੇ ਇਨ੍ਹਾਂ ਦੀ ਬੋਲੀ ਦਾ ਵੀ ਕਾਫ਼ੀ ਅੰਤਰ ਹੈ ਮਾਝੇ ਵਿੱਚ ਮਾਝੀ ਭਾਸ਼ਾ ਅਤੇ ਮਾਲਵੇ ਵਿੱਚ ਮਲਵਈ ਬੋਲੀ ਜਾਂਦੀ ਹੈ ਜੋ ਇਲਾਕੇ ਬਾਡਰ ਨਾਲ ਲੱਗਦੇ ਹਨ ਉਨ੍ਹਾਂ ਵਿੱਚ ਹੜ੍ਹ ਆਉਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਜਿਵੇਂ ਕਿ ਪਠਾਨਕੋਟ ਦੇ ਨਾਲ ਲੱਗਦੇ ਇਲਾਕੇ ਵਿੱਚ ਇਨ੍ਹਾਂ ਦਾ ਕਾਰਨ ਇਹ ਹੈ ਕਿ ਇਹ ਇਲਾਕੇ ਦਰਿਆਵਾਂ ਦੇ ਨਾਲ ਲੱਗਦੇ ਹਨ ਜਿਨ੍ਹਾਂ ਵਿੱਚ ਹੜ੍ਹ ਆਉਣ ਦੀ ਕਾਫੀ ਸਮੱਸਿਆ ਵੱਧ ਜਾਂਦੀ ਹੈ